ਤਿੰਨ ਮਾਰਚ ਉੱਨੀ ਸੌ ਤਰਾਨਵੇਂ ਤਿੰਨ ਫਰਵਰੀ ਦੋ ਹਜ਼ਾਰ ਇੱਕੀ ਤਿੰਨ ਮਾਰਚ ਦੋ ਹਜ਼ਾਰ ਇੱਕ ਇੱਕੀ ਮਾਰਚ ਉੱਨੀ ਸੌ ਚੁਹੱਤਰ ਪੰਦਰਾਂ ਮਾਰਚ ਉੱਨੀ ਪੈਂਹਠ